ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਕੋਈ ਨਾ ਕੋਈ ਜ਼ਰੂਰ ਮਤਲਬ ਸੈਰ ਦੌੜਨਾ ਜੋਗਿੰਗ ਇਹ ਸਭ ਕੁਝ ਬਹੁਤ ਜ਼ਿਆਦਾ ਮਹੱਤਵ ਰੱਖਦਾ ਹੈ ਕਿਉਂ ਰੱਖਦਾ ਹੈ ਮਹੱਤਵ ਕਿਉਂਕਿ ਜੇ ਆਪਾਂ ਖਾਈ ਜਾਵਾਂਗੇ ਸਿਰਫ ਕੋਈ ਆਪਾਂ ਕਸਰਤ ਨਹੀਂ ਕਰ ਰਹੇ ਸੈਰ ਨਹੀਂ ਕਰ ਰਹੇ ਤਾਂ ਫਿਰ ਉਹ ਫਿਰ ਮਤਲਬ ਖਾਇਆ ਪੀਆ ਸੌ ਗਏ ਇਹ ਜੀਵਨ ਨਹੀਂ ਹੈ ਜੀਵਨ ਨੂੰ ਜਿਉਣ ਦਾ ਤਰੀਕਾ ਇਹੀ ਹੈ ਵੀ ਬੰਦਾ ਆਪਣਾ ਟਾਈਮ ਨਾਲ ਕਸਰਤ ਕਰੇ ਵਧੀਆ ਤਰ੍ਹਾਂ ਆਪਣੇ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਮੇਂ ਦੇ ਮੌਸਮ ਦੇ ਹਿਸਾਬ ਦੇ ਨਾਲ ਆਪਣਾ ਜਿਹੜਾ ਹੈਗਾ ਉਹ ਹਰ ਕੰਮ ਕਰੇ ਤਾਂ ਜੋ ਉਸਨੂੰ ਆਪਣੇ ਆਉਣ ਵਾਲੇ ਜਿਹੜੇ ਮਤਲਬ ਓਲਡ ਏਜ ਦੇ ਵਿੱਚ ਕਿਸੇ ਵੀ ਦਿੱਕਤ ਦੀ ਜਿਹੜਾ ਸਾਹਮਣਾ ਨਾ ਕਰਨਾ ਪਵੇ ਦਿੱਕਤ ਪਰੇਸ਼ਾਨੀ ਉਸ ਨੂੰ ਬਿਲਕੁਲ ਵੀ ਨਾ ਆਵੇ ਅਤੇ ਜਿਹੜਾ ਆਪਣਾ ਜੇ ਮੈਂ ਦੱਸਾਂ ਤਾਂ ਮੈਂ ਸੈਰ ਕਰਦੀ ਹੁੰਦੀ ਹਾਂ ਗਰਮੀਆਂ ਦੇ ਮੌਸਮ ਦੇ ਵਿੱਚ ਥੋੜ੍ਹੀ ਜ਼ਿਆਦਾ ਹੋ ਜਾਂਦੀ ਹੈ ਐਕਸਰਸਾਈਜ਼ ਵੀ ਹੋ ਜਾਂਦੀ ਹੈ ਗਰਮੀਆਂ ਦੇ ਮੌਸਮ ਵਿੱਚ ਥੋੜ੍ਹਾ ਸਰਦੀਆਂ 'ਚ ਮੁਸ਼ਕਲ ਹੋ ਜਾਂਦਾ ਪਰ ਸ਼ਾਮ ਨੂੰ ਪੰਦਰਾਂ ਵੀਹ ਮਿੰਟ ਅੱਧਾ ਘੰਟਾ ਲਗਾ ਕੇ ਅਸੀਂ ਕੋਸ਼ਿਸ਼ ਕਰ ਹੀ ਲੈਂਦੇ ਹਾਂ ਅਤੇ ਸੈਰ ਕਰ ਲੈਂਦੇ ਹਾਂ ਅਤੇ ਇਹ ਚੀਜ਼ ਹੈ ਜਿਹੜੀ ਇਹ ਚੀਜ਼ ਸਾਡਾ ਖਾਣੇ ਨੂੰ ਡਾਏਜਸਟ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਮਦਦ ਕਰਦੀ ਹੈ ਸਾਡੀ ਵੀ ਖਾਣਾ ਡਾਏਜਸਟ ਹੋਣ ਦੇ ਵਿੱਚ ਕਾਫੀ ਜ਼ਿਆਦਾ ਬੈਨੀਫਿਸ਼ੀਅਲ ਹੈ ਇਹ ਹੈਲਪਫੁਲ ਹੈ ਅਤੇ ਇਹਦੇ ਨਾਲ ਇੱਦਾਂ ਹੁੰਦਾ ਵੀ ਜਿੰਨੀ ਤੇ ਵੱਧ ਤੋਂ ਵੱਧ ਤੇਜ਼ ਤੁਰਨਾ ਸੈਰ ਕਰਨਾ ਇਹ ਸਭ ਕੁਛ ਇਹ ਜਦੋਂ ਜਿੰਨਾ ਜ਼ਿਆਦਾ ਹੋਵੇ ਓਨਾ ਜ਼ਿਆਦਾ ਆਪਣੇ ਸਰੀਰ ਨੂੰ ਸਿਹਤਮੰਦ ਰੱਖਦਾ ਪੌੜ੍ਹੀਆਂ ਚੜ੍ਹ ਲੈਣੀਆਂ ਦਸ ਵਾਰ ਪੰਦਰਾਂ ਵਾਰ ਕਸਰਤ ਹੈ ਇੱਕ ਸੈਰ ਹੈ ਲੱਤਾਂ ਦੀ ਸੈਰ ਹੈ ਤੁਰਨਾ ਹੋ ਜਾਂਦਾ ਅਤੇ ਰੱਸੀ ਟੱਪਣਾ ਐਕਸਰਸਾਈਜ਼ ਕਰਨੀ ਜਿਵੇਂ ਆਪਾਂ ਫੋਨ ਤੋਂ ਦੇਖ ਕੇ ਔਨਲਾਈਨ ਯੋਗਾ ਵੀ ਕਰ ਸਕਦੇ ਹਾਂ ਘਰ ਬੈਠੇ ਹੋਏ ਇਹ ਸਭ ਚੀਜ਼ਾਂ ਨੇ ਆਪਣੇ ਆਪ ਨੂੰ ਸਿਹਤਮੰਦ ਰੱਖਣ ਦੀਆਂ ਡਾਕਟਰ ਤੋਂ ਦੂਰ ਰੱਖਣ ਦੀਆਂ ਹੋਸਪਿਟਲਾਂ ਦੇ ਚੱਕਰ ਨਹੀਂ ਕੱਟਣੇ ਤਾਂ ਆਪਣੇ ਆਪ ਨੂੰ ਵੀ ਮੈਂ ਇਹ ਸਲਾਹ ਦਿੰਦੀ ਹਾਂ ਵੀ ਵੱਧ ਤੋਂ ਵੱਧ ਸੈਰ ਕਰਿਆ ਕਰ ਲਉ ਜਿੰਨਾ ਕੁ ਟਾਈਮ ਨਿਕਲਦਾ ਚਲੋ ਸਰਦੀਆਂ 'ਚ ਥੋੜ੍ਹਾ ਜਿਹਾ ਹੋ ਜਾਂਦਾ ਪਰ ਗਰਮੀਆਂ 'ਚ ਬਹੁਤ ਵਧੀਆ ਸੈਰ ਹੁੰਦੀ ਹੈ ਕਿਉਂਕਿ ਮੌਸਮ ਖੁੱਲ੍ਹਾ ਹੁੰਦਾ ਨਾ ਵਧੀਆ ਹੁੰਦਾ ਮੌਸਮ ਅਤੇ ਇਹਦੇ ਨਾਲ ਇੱਦਾਂ ਹੁੰਦਾ ਫਰਕ ਪੈਂਦਾ ਮੌਸਮ ਮੌਸਮ ਦਾ ਵੀ ਬਹੁਤ ਜ਼ਿਆਦਾ ਉਹੀ ਹੁੰਦਾ ਵੀ ਬੰਦਾ ਜਿਹੜਾ ਹੈਗਾ ਜਦੋਂ ਸੈਰ ਕਰਨੀ ਇੱਕ ਵਾਰੀ ਸ਼ੁਰੂ ਕਰ ਦਿੰਦਾ ਫਿਰ ਉਹਦੀ ਰੂਟੀਨ ਬਣ ਜਾਂਦੀ ਹੈ ਫਿਰ ਉਹਦੇ ਨਾਲ ਅੱਜ ਕੱਲ੍ਹ ਤਾਂ ਕਿੰਨੇ ਜ਼ਿਆਦਾ ਪਾਰਕ ਖੁੱਲੇ ਹੋਏ ਆ ਉਹਦੇ 'ਚ ਪਾਰਕ ਦੇ ਵਿੱਚ ਐਕਸਰਸਾਈਜ਼ ਮਸ਼ੀਨਾਂ ਪਈਆਂ ਨੇ ਹੈ ਨਾ ਉਹਦੇ ਨਾਲ ਤੁਸੀਂ ਬਹੁਤ ਅੱਛਾ ਆਪਣੇ ਆਪ ਨੂੰ ਮੈਨਟੇਨ ਰੱਖ ਸਕਦੇ ਹੋ ਔਰ ਮੇਨਟੇਨਡ ਹੀ ਅੱਛੇ ਲੱਗਦੇ ਫਾਲਤੂ ਸਰੀਰ ਲੈ ਕੇ ਤੁਰੀ ਜਾਣਾ ਫਾਲਤੂ ਮਾਸ ਲਟਕ ਰਿਹਾ ਤੁਹਾਡਾ ਉਹ ਕੋਈ ਫਾਇਦੇਮੰਦ ਨਹੀਂ ਹੈ ਉਹ ਯੂਜਲੈਸ ਹੈ ਤੁਹਾਡਾ ਜਿਹੜੀ ਉਹ ਸਰੀਰ ਹੈ ਨਾ ਉਹ ਯੂਜਲੈਸ ਹੈ ਅਤੇ ਜਦੋਂ ਯੂਜਲੈਸ ਜਿਹੜੀ ਚੀਜ਼ ਹੁੰਦੀ ਹੈ ਉਸਨੂੰ ਫਿਰ ਐਕਸਟਰਾ ਨੂੰ ਬਾਹਰ ਕੱਢਣਾ ਤਾਂ ਬਹੁਤ ਜ਼ਰੂਰੀ ਹੁੰਦਾ ਸੋ ਥੋੜ੍ਹੀ ਬਹੁਤ ਗਤੀਆਂ ਵਿਧੀਆਂ ਕਰ ਲੈਣੀਆਂ ਚਾਹੀਦੀਆਂ ਨੇ ਜ਼ਰੂਰ ਕਰ ਲੈਣੀਆਂ ਚਾਹੀਦੀਆਂ ਨੇ ਦਿਸ ਇਜ ਦਾ ਮਾਈ ਬੈਸਟ ਸੂਜੈਸ਼ਨ ਫੋਰ ਔਲ ਔਫ ਅਸ ਫੋਰ ਮਾਈ ਫੈਮਲੀ ਐਂਡ ਬਾਕੀ ਸਾਰਿਆਂ ਲਈ ਮੇਰੀ ਫੈਮਲੀ ਲਈ ਸਭ ਲਈ ਬਹੁਤ ਜ਼ਿਆਦਾ ਹੈ ਅਤੇ ਇਹੀ ਜੀ ਮੇਰੀ ਗਤੀਵਿਧੀ ਹੈ ਇਹੀ ਕਰਦੀ ਹਾਂ ਮੈਂ ਬਸ ਉਹੀ ਦੱਸ ਰਹੀ ਹਾਂ ਵੀ ਗਰਮੀਆਂ ਦੇ ਵਿੱਚ ਜ਼ਿਆਦਾ ਕਰ ਲੈਂਦੇ ਹਾਂ ਸਰਦੀਆਂ 'ਚ ਥੋੜ੍ਹੀ ਘੱਟ ਜਾਂਦੀ ਹੈ ਪਰ ਫਿਰ ਉੱਦਾਂ ਤੁਰੇ ਤੁਰਦੇ ਰਹੀਦਾ ਤੁਰਦੇ ਰਹਿਣਾ ਹੀ ਜ਼ਿੰਦਗੀ ਹੈ ਤੁਰਦੇ ਪਾਣੀਆਂ ਪਾਣੀ ਹੀ ਚੰਗੇ ਲੱਗਦੇ ਨੇ ਖੜ੍ਹਾ ਹੋਇਆ ਪਾਣੀ ਤਾਂ ਜੰਗਾਲ ਆ ਜਾਂਦੀ ਆ ਉਹਦੇ 'ਚ ਜੀ ਧੰਨਵਾਦ ਜੀ